ਮੈਂ ਸ਼ੀਤਲ ਵਾਸੀ ਮਿਰਜ਼ਾਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਪਰਿਵਾਰ ਸਮੇਤ ਕੱਲ੍ਹ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਉਣ ਲਈ ਸੇਵਾ ਟਰੈਵਲ ਏਜੰਸੀ ਨੂੰ ਫੋਨ ਕੀਤਾ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਮੈਂ ਜਦੋਂ ਫੋਨ ਕੀਤਾ ਤਾਂ ਮੈਂ ਕਿਹਾ ਸੀ ਕਿ ਸਵੇਰੇ ਸੱਤ ਵਜੇ ਸਾਨੂੰ ਮਿਰਜ਼ਾਪੁਰ ਤੋਂ ਲੈ ਕੇ ਤੁਸੀਂ ਅੰਮ੍ਰਿਤਸਰ ਜਾਣਾ ਹੈ ਪਰ ਅੱਜ ਮੈਨੂੰ ਪਤਾ ਲੱਗ ਗਿਆ ਹੈ ਕਿ ਕੱਲ੍ਹ ਇਹ ਕੁਝ ਕਾਰਨਾਂ ਕਰਕੇ ਇਹ ਰੋਡ ਬੰਦ ਹੈ ਇਸ ਕਰਕੇ ਮੈਂ ਆਪਣਾ ਪਿੱਕਅੱਪ ਪ੍ਰੋਡੈਕਟ ਔਂ ਹੁਣ ਪਠਾਨਕੋਟ ਕਰ ਲਿਆ ਹੈ ਮੈਨੂੰ ਸਵੇਰੇ ਅੱਠ ਵਜੇ ਪਠਾਨਕੋਟ ਬੱਸ ਸਟੈਂਡ ਤੋਂ ਲੈ ਲਿਆ ਜਾਵੇ ਤਾਂ ਕਿ ਅਸੀਂ ਸਮੇਂ ਸਿਰ ਆਪਣੇ ਟਿਕਾਣੇ ਅੰਮ੍ਰਿਤਸਰ ਪੁੱਜ ਸਕੀਏ ਮੈਂ ਤੁਹਾਨੂੰ ਇਸ ਦਾ ਕਰਾਇਆ ਔਨਲਾਈਨ ਭੇਜ ਦਿੱਤਾ ਹੈ ਇਸ ਲਈ ਕਿਰਪਾ ਕਰਕੇ ਮੈਂ ਮੇਰਾ ਸਮਾਂ ਸਥਾਨ ਪਤਾ ਨੋਟ ਕਰ ਲਿਆ ਜਾਵੇ ਅਤੇ ਠੀਕ ਸਮੇਂ 'ਤੇ ਮੈਨੂੰ ਮਿਰਜ਼ਾਪੁਰ ਦੀ ਜਗ੍ਹਾ ਪਠਾਨਕੋਟ ਤੋਂ ਲੈ ਲਿਆ ਜਾਵੇ ਧੰਨਵਾਦ